ਹਾਂ ਜੇਕਰ ਅੱਜ ਕੱਲ੍ਹ ਸਕੂਲ ਟਾਈਮ ਦੀ ਗੱਲ ਕਰੀਏ ਤਾਂ ਮੈਨੂੰ ਇਤਿਹਾਸਿਕ ਬੁੱਕਸ ਪੜ੍ਹਨ ਦੀ ਪੜ੍ਹਨ ਦਾ ਬਹੁਤ ਸ਼ੌਂਕ ਸੀ ਮੈਂ ਸਕੂਲ ਟਾਈਮ ਦੀ ਹੀ ਬੁੱਕਸ ਪੜ੍ਹਦੀ ਆਉਂਦੀ ਹਾਂ ਅਤੇ ਮੈਨੂੰ ਇਤਿਹਾਸ ਦੀਆਂ ਬੁੱਕਸ ਪੜ੍ਹਨ ਦੇ ਵਿੱਚ ਬਹੁਤ ਸਾਰਾ ਗਿਆਨ ਮਿਲਿਆ ਹੈ ਮੇਰੇ ਨਾਲ ਜਦੋਂ ਨਾ ਮੇਰੇ ਸਕੂਲ ਦੇ ਵਿੱਚ ਕੰਪੀਟੀਸ਼ਨ ਹੁੰਦਾ ਸੀ ਤਾਂ ਮੇਰੇ ਟੀਚਰ ਮੇਰਾ ਆਪਣੇ ਆਪ ਹੀ ਨਾਂ ਲਿਖਵਾ ਦਿੰਦੇ ਸੀ ਮੈਨੂੰ ਬੜਾ ਸ਼ੌਂਕ ਸੀ ਹਰ ਇੱਕ ਕੰਪੀਟੀਸ਼ਨ ਵਿੱਚ ਭਾਗ ਲੈਣ ਦਾ ਅਤੇ ਮੈਂ ਫਰਸਟ ਆਉਂਦੀ ਸੀ ਮੈਨੂੰ ਲਿਖਣ ਦਾ ਬੜਾ ਸ਼ੌਂਕ ਸੀ ਬੁੱਕਸ ਪੜ੍ਹਦੀ ਸੀ ਹੁਣ ਜਦੋਂ ਦੀਆਂ ਬੁੱਕਸ ਪੜ੍ਹੀਆਂ ਹੋਈਆਂ ਹੁਣ ਤੱਕ ਬੁੱਕਸ ਪੜ੍ਹ ਪੜ੍ਹ ਕੇ ਹੀ ਮੈਂ ਅੱਜ ਸਿੱਖੀ ਦੇ ਰਾਹ ਵਿੱਚ ਆ ਸਿੱਖੀ ਦੇ ਰਾਹ ਉੱਤੇ ਤੁਰੀ ਹਾਂ ਅਤੇ ਅਤੇ ਅੱਜ ਅੱਜ ਦੇ ਟਾਈਮ ਮੈਂ ਉਹ ਬੁੱਕਸ ਪੜ੍ਹ ਪੜ੍ਹ ਕੇ ਹੀ ਅੱਜ ਢਾਡੀ ਵਾਰਾਂ ਗਾ ਰਹੀ ਹਾਂ ਅਤੇ ਢਾਡੀ ਵਾਰਾਂ ਗਾ ਗਾ ਕੇ ਅੱਜ ਮੇਰਾ ਇੰਨਾ ਕੁ ਦੁਨੀਆ 'ਤੇ ਨਾਂ ਹੈ ਕਿ ਹਰ ਇੱਕ ਹਰ ਇੱਕ ਦੁਨੀਆ ਮੈਨੂੰ ਜਾਣਦੀ ਹੈ ਹਰ ਇੱਕ ਬੱਚਾ ਬੱਚਾ ਜਾਣਦਾ ਕਿਸੇ ਨੂੰ ਮੇਰੇ ਬਾਰੇ ਕੁਝ ਦੱਸਣ ਦੀ ਲੋੜ ਨਹੀਂ ਪੈਂਦੀ ਹਰ ਇੱਕ ਬੱਚੇ ਨੂੰ ਪਤਾ ਕਿ ਹਾਂ ਇਸ ਧਰਤੀ ਦੇ ਉੱਤੇ ਜਾਂ ਇਸ ਪਿੰਡ ਦੇ ਵਿੱਚ ਹਰਜਿੰਦਰ ਕੌਰ ਰਹਿ ਰਹੀ ਹੈ ਢਾਡੀ ਵਾਰਾਂ ਦਾ ਮੈਨੂੰ ਬਹੁਤ ਸ਼ੌਂਕ ਹੈ ਬੁੱਕਸ ਪੜ੍ਹਨ ਦਾ ਬਹੁਤ ਸ਼ੌਂਕ ਸੀ ਅਤੇ ਮੇਰੇ ਟੀਚਰ ਮੈਨੂੰ ਬੜਾ ਪਿਆਰ ਕਰਦੇ ਸੀ ਕਿ ਮੈਂ ਇਤਿਹਾਸਿਕ ਰਸਤੇ ਰਸਤ ਇਤਿਹਾਸਿਕ ਰਾਹ ਉੱਤੇ ਜਾ ਰਹੀ ਹਾਂ